ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਰੋਪੜ ਤੋਂ ਬੋਲਦੇ ਹਾਂ ਸਟੇਸ਼ਨ ਤੋਂ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਅੰਬਰਸਰ ਨੂੰ ਸ਼ੁਭ ਕੀ ਨਾਂ ਜੀ ਆਪਣਾ ਹਾਂ ਬੂਟਾ ਸਿੰਘ ਬੂਟਾ ਸਿੰਘ ਜੀ ਅੰਬਰਸਰ ਨੂੰ ਟ੍ਰੇਨ ਰੋਜ਼ ਸਵੇਰੇ ਸਾਢੇ ਸੱਤ ਵਜੇ ਜਾਂਦੀ ਹੈ ਜੀ ਉੱਥੇ ਢਾਈ ਵਜੇ ਪਹੁੰਚ ਜਾਂਦੀ ਹੈ ਅੰਬਰਸਰ ਜੀ

ਅੱਛਾ ਜੀ ਇਹ ਸਲਿੱਪਰ ਕਲਾਸ ਦੀ ਜਿਹੜੀ ਟਿਕਟ ਹੈ ਉਹ ਹੈਗੀ ਹੈ ਜੀ ਇੱਕ ਸੌ ਵੀਹ ਰੁਪਏ ਦੀ ਜੇ ਤੁਸੀਂ ਸੈਕਿੰਡ ਏ ਸੀ ਵਿੱਚ ਜਾਣਾ ਜਾਂ ਫਸਟ ਏ ਸੀ ਵਿੱਚ ਜਾਣਾ ਜੀ ਉਹ ਹੈਗੀ ਹੈ ਜੀ ਸੱਤ ਸੌ ਸੱਤਰ ਰੁਪਈਆ ਟਿਕਟ ਸੈਕਿੰਡ ਕਲਾਸ ਦੀ ਅਤੇ ਫਸਟ ਕਲਾਸ ਦੀ ਹੈਗੀ ਹੈ ਨੋ ਸੌ ਵੀਹ ਰੁਪਈਆ ਹਾਂਜੀ ਖਾਣਾ ਪਾਣੀ ਤਾਂ ਜਿਹੜਾ ਆਪਣਾ ਰੇਲਵੇ 'ਚ ਪੇੈਂਟਰੀ ਦਾ ਹੁੰਦਾ ਤੁਸੀਂ ਆਪਣਾ ਅੰਮ੍ਰਿਤਸਰ ਨੂੰ ਟ੍ਰੇਨ ਜਾਂਦੀ ਹੈ ਨੋਨ ਵੈੱਜ ਤਾਂ ਨਹੀਂ ਮਿਲਣਾ ਤੁਹਾਨੂੰ ਵੈੱਜ ਹੀ ਮਿਲਣਾ ਇਹਦੇ ਵਿੱਚ ਰੋਟੀ ਮਿਲ ਜਾਊਗੀ ਜੀ ਚਾਵਲ ਮਿਲ ਜਾਊਗੇ ਦਾਲ ਮਿਕਸ ਸਬਜ਼ੀ ਹੁੰਦੀ ਹੈ ਜੀ ਅਤੇ ਤੁਸੀਂ ਜਿੱਦਾਂ ਵੀ ਉਹ ਵੀ ਸਵੇਰੇ ਸਵੇਰੇ ਤੁਹਾਨੂੰ ਬਰੇਕਫਾਸਟ ਬਰੇਕਫਾਸਟ ਜੇ ਤੁਸੀਂ ਲੈਣਾ ਚਾਹੋ ਲੈਣਾ ਚਾਹੋ ਤਾਂ ਮਿਲ ਜਾਊਗਾ ਵੀ ਏਦਾਂ ਨਹੀਂ ਬਾਕੀ ਲੰਚ ਜੇ ਤੁਸੀਂ ਡੇਢ ਵਜੇ ਲੰਚ ਜੇ ਤੁਸੀਂ ਲੈਣਾ ਹੈ ਤਾਂ ਤੁਹਾਡੇ ਕੋਲ ਆਪਣਾ ਕੀ ਕਹਿੰਦੇ ਹੈ ਪੈਂਟਰੀ ਵਾਲੇ ਆ ਜਾਂਦੇ ਹੈ ਤੁਸੀਂ ਪਹਿਲਾਂ ਨੋਟ ਕਰਾ ਦਿਉ ਓਨੇ ਓਨੇ ਲੰਚ ਤੁਹਾਡੇ ਕੋਲ ਆ ਜਾਊਗਾ ਹਾਂਜੀ ਹਾਂਜੀ ਉਹ ਤਾਂ ਜੋ ਅੰਬਰਸਰ ਤੋਂ ਤੁਸੀਂ ਜਾਣਾ ਤੁਸੀਂ ਬੁਕਿੰਗ ਤੁਹਾਡੀ ਰੋਪੜ ਤੋਂ ਵੀ ਹੋ ਸਕਦੀ ਹੈ ਕੋਈ ਗੱਲ ਨਹੀਂ ਇਹਦੀ ਉਹ ਉੱਥੇ ਦੀ ਜਿਹੜੀ ਟਿਕਟ ਹੈ ਜੀ ਉਹ ਅਲੱਗ ਹੈ ਜਿੱਦਾਂ ਹੁਣ ਸਲਿੱਪਰ ਦੀ ਹੈ ਜੀ ਸਲਿੱਪਰ ਦੀ ਹੈਗੀ ਹੈ ਸਾਢੇ ਗਿਆਰਾਂ ਸੌ ਰੁਪਏ ਦੀ ਜੇ ਤੁਸੀਂ ਨੰਦੇੜ ਸਾਹਿਬ ਜਾਣਾ ਹੈ ਅਤੇ ਤੁਸੀਂ ਜਿੱਦਾਂ ਏ ਸੀ ਦੀ ਲੈਣੀ ਹੈ ਸੈਕਿੰਡ ਕਲਾਸ ਦੀ ਫਸਟ ਕਲਾਸ ਦੀ ਇਹ ਨੀਅਰ ਅਬਾਊਟ ਸੋਲ੍ਹਾ ਸੌ ਤੋਂ ਲੈ ਕੇ ਦੋ ਹਜ਼ਾਰ ਦੇ ਵਿੱਚ ਵਿੱਚ ਹੈਗੀ ਹੈ ਜੀ ਉਹ ਤੁਸੀਂ ਜਿੱਦਾਂ ਆਪਣੇ ਮੈਂਬਰ ਤੁਹਾਡੇ ਕਿੰਨੇ ਹੈ ਆਪਣਾ ਪਲੈਨ ਕਰ ਲਉ ਹੈ ਨਾ ਪਤਾ ਕੋਈ ਨਹੀਂ ਹੈਗਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ